ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਸੀਂ ਕਈ ਲੋਕਾਂ ਕੋਲ ਸੁਣਿਆ ਹੁੰਦਾ ਸੁਣਦੇ ਹੁੰਦੇ ਸੀ ਅਤੇ ਫਿਲਮਾਂ ਵਿੱਚ ਵੀ ਦੇਖਦੇ ਹੁੰਦੇ ਸੀ ਨਾਟਕਾਂ ਵਿੱਚ ਵੀ ਸੁਣਦੇ ਹੁੰਦੇ ਸੀ ਵੀ ਭਾਈ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਉਹ ਤਾਰਾ ਬਣ ਜਾਂਦਾ ਸੀ ਅਤੇ ਬਣ ਜਾਂਦਾ ਹੈ ਅਤੇ ਉਸ ਸਮੇਂ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੀ ਇੱਕ ਵਾਰ ਜਦੋਂ ਮੇਰੀ ਦਾਦੀ ਜੀ ਦੀ ਅ ਮੌਤ ਹੋ ਗਈ ਤਾਂ ਬਾਅਦ ਵਿੱਚ ਮੈਂ ਇਹ ਹੀ ਇੱਕ ਵਾਰੀ ਵਿਹੜੇ 'ਚ ਬੈਠਾ ਮਹਿਸੂਸ ਕਰੀ ਗਿਆ ਕਿ ਮੇਰੀ ਦਾਦੀ ਵੀ ਇਹਨਾਂ ਵਿੱਚੋਂ ਕੋਈ ਤਾਰਾ ਬਣ ਗਈ ਹੈ ਸੋ ਸਾਡੇ ਖੇਤਰਾਂ ਦੇ ਵਿੱਚ ਜੋ ਤਾਰਿਆਂ ਪ੍ਰਤੀ ਬਹੁਤ ਮਿੱਥਾਂ ਮਸ਼ਹੂਰ ਹਨ